ਮੈਂ ਆਰਮੀ ਦੇ ਵਿੱਚ ਵੀ ਕਾਫੀ ਦੌੜ ਕਰੋਸ ਕੰਟਰੀ ਕਰਦਾ ਰਿਹਾ ਹਾਂ ਉਸ ਵਿੱਚ ਵੀ ਕਈ ਵਾਰੀ ਸੱਟ ਫੇਟ ਖਾਧੀ ਹੈ ਫ਼ਿਰ ਵੀ ਅਸੀਂ ਪਿੰਡ 'ਚ ਜੰਗਲਾਂ ਦੇ ਵਿੱਚ ਜਾਂਦੇ ਰਹੇ ਹਾਂ ਜਾਂਦੇ ਜੁਂਦੇ ਕਈ ਵਾਰੀ ਉਪਰੋਂ ਡਿੱਗ ਕੇ ਲੱਕੜ ਵਗੈਰਾ ਤੋੜਦੇ ਕਰਦੇ ਸੱਟਾਂ ਖਾਦੀਆਂ ਹਨ ਸੱਟਾਂ ਦੇ ਫਿਰ ਅਸੀਂ ਤੇਲ ਹਲਦੀ ਦੇ ਲੇਪ ਕਰਕੇ ਸਾਫ ਸੁਥਰੇ ਕੱਪੜੇ ਨਾਲ਼ ਬੰਨ ਲੈਂਦੇ ਸੀ ਉਹ ਕੁਝ ਦਿਨਾਂ ਲਈ ਬੰਨ ਕੇ ਅਤੇ ਫਿਰ ਉਹਦਾ ਅਰ ਆਰਾਮ ਨਾਲ਼ ਠੀਕ ਹੋ ਜਾਂਦਾ ਸੀ ਹੱਡੀਆਂ ਵੀ ਟੁੱਟ ਜਾਂਦੀਆਂ ਸੀ ਉਹ ਵੀ ਪਹਿਲੇ ਟਾਈਮਾਂ ਤੇ ਫੱਟੀਆਂ ਲਗਾ ਕੇ ਪਤਲੀਆਂ ਬਾਂਸ ਦੀਆਂ ਕੱਪੜੇ ਦੇ ਨਾਲ਼ ਲਪੇਟ ਕੇ ਉਹਦੇ ਨਾਲ਼ ਵੀ ਅਸੀਂ ਇਲਾਜ ਕਰਾ ਕਰਦੇ ਰਹੇ ਹਾਂ ਕਿ ਕਈ ਵਾਰੀ ਮੈਂ ਆਰਮੀ ਦੇ ਵਿੱਚ ਦੌੜ ਲਗਾ ਕੇ ਸਾਨੂੰ ਗਿਫਟ ਵਗੈਰਾ ਵੀ ਮਿਲਦਾ ਸੀ ਫਸਟ ਆਉਣ ਤੋਂ ਸਾਨੂੰ ਗਿਲਾਸ ਜਾਂ ਨਾਉਣ ਵਾਲੇ ਸਾਬਣ ਦੀ ਟਿੱਕੀ ਮਿਲਦੀ ਸੀ ਮੈਂ ਉਹ ਬਹੁਤ ਮਿਹਨਤ ਕਰਕੇ ਹਿੰਮਤ ਕਰਕੇ ਲੈਂਦਾ ਰਿਹਾ ਸੀ ਜ ਹੋਰ ਜੰਗਲਾਂ ਦੇ ਵਿੱਚ ਵੀ ਰਹੇ ਹਾਂ ਉੱਥੇ ਵੀ ਪੈਦਲ ਬਹੁਤ ਜ਼ਿਆਦਾ ਚਲਦੇ ਰਹੇ ਹਾਂ ਚਲਕੇ ਬਾਰ੍ਹਾਂ ਬਾਰ੍ਹਾਂ ਕਿਲੋਮੀਟਰ ਵੀ ਜੰਗਲਾਂ ਦੇ ਵਿੱਚ ਪੈਦਲ ਸੰਘਣੇ ਘਣੇ ਜੰਗਲਾਂ ਦੇ ਵਿੱਚ ਜਾਣਾ ਪੈਂਦਾ ਸੀ ਉੱਥੇ ਵੀ ਨਿਕਲਦੇ ਰਹੇ ਹਾਂ